ਸਾਨੂੰ ਆਪਣੇ ਸਮਾਜ ਦੇ ਸੱਭਿਆਚਾਰਕ ਜਿਹੜੇ ਪਰੰਪਰਾਗਤ ਪਹਿਰਾਵੇ ਹੈ ਜਿਵੇਂ ਕੁੜਤਾ ਪਜਾਮਾ ਜਨਾਨੀ ਸਲਵਾਰ ਕਮੀਜ਼ ਪਹਿਨਦੀ ਹੈ ਗਹਿਣਿਆਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਜ਼ਿਆਦਾਤਰ ਉਹ ਹੈਗਾ ਵੀ ਕੈਂਠਾ ਪਹਿਨਦੇ ਹੈ ਉਹ ਕੈਂਠਾ ਪਹਿਨਦੇ ਪੁਰਾਣੇ ਸਮੇਂ 'ਚ ਜਿੱਦਾਂ ਜ ਔਰਤਾਂ ਤਵੀਜ਼ ਵੀ ਪਹਿਨਦੀਆਂ ਸੀ ਇਹ ਜਿਹੜੇ ਕੈਂਠੇ ਕੈਂਠੇ ਵਾਲਾ ਅਤੇ ਤਵੀਜ਼ ਪਹਿਨਣ ਵਾਲਾ ਇਹ ਹੋਰ ਸਟੇਟਾਂ ਦੇ ਵਿੱਚ ਹੋਰ ਰਾਜਾਂ ਦੇ ਵਿੱਚ ਨਹੀਂ ਹੈ ਇਹ ਪੰਜਾਬ ਦੀ ਆਪਣੀ ਵਿਲੱਖਣਤਾ ਹੈ ਕਿ ਇਹਦੇ ਕੱਪੜੇ ਵੀ ਵੱਖਰੇ ਹੈ ਕੁੜਤਾ ਪਜਾਮਾ ਇਹਦਾ ਵੱਖਰਾ ਹੈ ਔਰ ਇਹਦਾ ਜਿਹੜਾ ਸਲਵਾਰ ਸਲਵਾਰ ਕਮੀਜ਼ ਦਾ ਲੇਡੀਜ਼ ਪਹਿਨਦੇ ਹੈ ਉਹ ਵੱਖਰਾ ਇਹ ਵੱਖ ਵੱਖ ਭਾਈਚਾਰਕ ਸਾਂਝਾ ਦੇ ਵਿੱਚ ਜਿਵੇਂ ਮੁਸਲਮਾਨ ਭਾਈਚਾਰੇ ਵਾਲੇ ਉਹ ਟੋਪੀ ਪਹਿਨਦੇ ਆ ਹਿੰਦੂ ਵਾਲੇ ਹੈ ਉਹ ਆਪਣਾ ਹੋਰ ਪਹਿਰਾਵਾ ਪਹਿਨਦੇ ਹੈ ਅਤੇ ਜਿਹੜੇ ਸਿੱਖ ਹੈ ਉਹ ਆਪਣੇ ਹੈ ਅਕਸਰ ਸਿਰ ਦੇ ਉੱਤੇ ਪੱਗੜੀ ਸਜਾਉਂਦੇ ਹੈ ਇਹ ਜਿਹੜੀ ਪੱਗੜੀ ਹੈ ਪੰਜਾਬ ਦੀ ਇੱਕ ਨਿਸ਼ਾਨੀ ਆ ਇਹ ਬਾਕਰੀ ਬਾਕੀ ਸੂਬਿਆਂ ਨਾਲੋਂ ਬਿਲਕੁਲ ਵੱਖਰੀ ਹੈ ਔਰ ਜਿਹੜੀ ਪੱਗੜੀ ਹੈ ਚਾਹੇ ਹਜ਼ਾਰ ਬੰਦਾ ਖੜ੍ਹਾ ਚਾਹੇ ਦੋ ਹਜ਼ਾਰ ਖੜ੍ਹਾ ਜੇ ਉਹਦੇ ਵਿੱਚ ਪੰਜ ਸੱਤ ਵਿਅਕਤੀ ਵੀ ਜਿਹੜੇ ਪੱਗੜੀ ਬੰਨ੍ਹੀ ਖੜ੍ਹੇ ਤਾਂ ਉਹ ਵੱਖਰੀ ਪਹਿਚਾਣ ਹੋ ਜਾਂਦੀ ਵੀ ਹਾਂ ਇਹ ਪੰਜਾਬ ਦੇ ਹੈ ਇਹ ਵਿਲੱਖਣਤਾ ਹੈ ਪੰਜਾਬ ਦੀ ਕਿ ਕੁੜਤੇ ਪਜਾਮੇ ਵਾਲਾ ਵਿਅਕਤੀ ਔਰ ਪੱਗੜੀ ਵਾਲਾ ਵਿਅਕਤੀ ਵੱਖਰੇ ਤੌਰ 'ਤੇ ਪਹਿਚਾਣ ਹੋ ਜਾਂਦਾ ਹਾਂ ਵੀ ਇਹ ਪੰਜਾਬ ਤੋਂ ਆ ਜੇ ਕਿਸੇ ਨੇ ਸਾੜੀ ਪਹਿਨੀ ਉਹਨੂੰ ਕਹਿੰਦਾ ਵੀ ਦੂਜੇ ਰਾਜ ਦਾ ਹੈ ਜੇ ਪੰਜਾਬ ਦੇ ਵਿੱਚ ਆ ਜਾਵੇ ਹਾਂ ਜੇ ਹਾਂ ਜੇ ਸਾੜੀ ਪਹਿਨਦੇ ਜ਼ਰੂਰ ਹੈ ਪੰਜਾਬ ਦੇ ਵਿੱਚ ਪਰ ਉਹ ਕਿਸੇ ਖਾਸ ਫਿਰਕੇ ਵਾਲੇ ਲੋਕ ਪਹਿਨਦੇ ਹੈ ਆ ਆਮ ਜਿਹੜਾ ਪੰਜਾਬੀ ਪਹਿਰਾਵਾ ਹੈ ਉਹ ਕੁੜਤਾ ਪਜਾਮਾ ਕਮੀਜ਼ ਪਜਾਮਾ ਅਤੇ ਹੈ ਪੱਗੜੀ ਪਹਿਨਦੇ ਹੈ ਸ ਜਿਹੜੇ ਸਿੰਘ ਲੋਕ ਹੈ ਸਰਦਾਰ ਲੋਕ ਹੈ ਉਹ ਪੱਗੜੀ ਪਹਿਨਦੇ ਹੈ ਜਿਹੜੀ ਔਰਤਾਂ ਉਹ ਆਪਣੇ ਸਿਰ ਦੇ ਉੱਤੇ ਦੁਪੱਟਾ ਲੈ ਕੇ ਰੱਖਦੀਆਂ ਉਹ ਵੀ ਵਿਲੱਖਣਤਾ ਹੈ ਪੰਜਾਬ ਦੀ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਕੋਈ ਵੀ ਹੈ ਸਤਿਕਾਰ ਵਜੋਂ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਘੱਟ ਹੈ ਕਿ ਕੋਈ ਸਤਿਕਾਰ ਵੱਜੋਂ ਆਪਣੇ ਸਿਰ ਨੂੰ ਢੱਕੇ ਪਰ ਇਹ ਪੰਜਾਬ ਦੀ ਵਿਲੱਖਣਤਾ ਹੈ ਕਿ ਇੱਥੇ ਔਰਤਾਂ ਜਿਹੜੀਆਂ ਉਹ ਚਾਹੇ ਕੋਈ ਸਿਆਣਾ ਬਜ਼ੁਰਗ ਹੈ ਉਹਨੂੰ ਦੇਖ ਕੇ ਵੀ ਆਪਣੇ ਸਿਰ ਦੇ ਉੱਤੇ ਦੁਪੱਟਾ ਲੈ ਲੈਣਾ ਚੁੰਨੀ ਲੈ ਲੈਣੀ ਇਹ ਵਿਲੱਖਣਤਾ ਹੈ ਔਰ ਹੱਥ ਜੋੜ ਕੇ ਬੁਲਾਉਣਾ ਹੈ ਅਤੇ ਪੰਜਾਬ ਦੀ ਜਿਹੜੀ ਵੱਖਰੀ ਨਿਸ਼ਾਨੀ ਹੈ ਕਿ ਉਹ ਹੈ ਪੱਗੜੀ ਦੀ ਨਿਸ਼ਾਨੀ ਸਿਰ ਦੇ ਉੱਤੇ ਜਿਹਨੂੰ ਅਸੀਂ ਦਸਤਾਰ ਵੀ ਕਹਿੰਦੇ ਹਾਂ ਅਤੇ ਉਹ ਪੰਜਾਬ ਦੀ ਲੋਕਾਂ ਦੀ ਸਾਡੇ ਭਾਈਚਾਰ ਸਾਂਝ ਦੇ ਵਿੱਚ ਇੱਕ ਵੱਖਰੀ ਪਹਿਚਾਣ ਰੱਖਦੀ ਹੈ